ਹੈਲੋ ਮੇਰੀ ਗੱਲ ਮੀਸ਼ੋ ਵਾਲਿਆ ਨਾਲ ਹੋ ਰਹੀ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਨਾ ਤੁਹਾਡੇ ਕੋਲੋਂ ਇੱਕ ਪ੍ਰੋਡਕਟ ਆਰਡਰ ਕੀਤਾ ਸੀ ਹਾਂਜੀ ਹਾਂਜੀ ਉਹ ਪ੍ਰੋਡਕਟ ਮੈਂ ਕੁੜਤੀ ਆਰਡਰ ਕੀਤੀ ਸੀ ਉਹ ਮੈਂ ਆਪਣੇ ਭਰਾ ਦੇ ਵਿਆਹ 'ਤੇ ਪਾਉਣੀ ਸੀ ਹਾਂਜੀ ਕੁੜਤੀ ਹਾਂਜੀ ਤੁਹਾਡਾ ਪ੍ਰੋਡਕਟ ਉਹ ਬਹੁਤ ਹੀ ਜ਼ਿਆਦਾ ਵਧੀਆ ਆਇਆ ਜਦੋਂ ਮੈਂ ਵਿਆਹ 'ਤੇ ਕੁੜਤੀ ਪਾ ਕੇ ਗਈ ਤਾਂ ਸਾਰਿਆਂ ਨੇ ਇੰਨੀ ਕੁ ਜ਼ਿਆਦਾ ਪਸੰਦ ਕੀਤੀ ਸਾਰਿਆਂ ਨੇ ਮੈਨੂੰ ਪੁੱਛਿਆ ਕਿ ਤੂੰ ਇਹ ਕੁੜਤੀ ਕਿੱਥੋਂ ਲਿੱਤੀ ਹੈ ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਮੀਸ਼ੋ ਤੋਂ ਇਹ ਕੁੜਤੀ ਪ੍ਰੋਡਕਟ ਮੰਗਵਾਇਆ ਹੈ ਹਾਂਜੀ ਕੁੜਤੀ ਦਾ ਪ੍ਰੋਡਕਟ ਇੰਨਾ ਜ਼ਿਆਦਾ ਵਧੀਆ ਸੀ ਅਤੇ ਕੁੜਤੀ ਦਾ ਕੱਪੜਾ ਵੀ ਬਹੁਤ ਹੀ ਜ਼ਿਆਦਾ ਵਧੀਆ ਸੀ ਮੈਂ ਕੁੜਤੀ ਦਾ ਕੱਪੜਾ ਜਦੋਂ ਪਾਇਆ ਤਾਂ ਮੈਨੂੰ ਬਿਲਕੁਲ ਵੀ ਚੁੱਭਣ ਵਾਲਾ ਕੁਝ ਵੀ ਮਹਿਸੂਸ ਨਹੀਂ ਹੋਇਆ ਅਤੇ ਉਹ ਬਹੁਤ ਹੀ ਪੋਲਾ ਪੋਲਾ ਸੀ ਹਾਂਜੀ ਪ੍ਰੋਡਕਟ ਬਹੁਤ ਹੀ ਵਧੀਆ ਸੀ ਅਤੇ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਆਇਆ ਮੈਂ ਉਮੀਦ ਕਰਦੀ ਹਾਂ ਕਿ ਅਗਲੇ ਵੀ ਜਿੰਨੇ ਵੀ ਪ੍ਰੋਡਕਟ ਹੋਣਗੇ ਮੈਂ ਤੁਹਾਡੇ ਕੋਲੋਂ ਮੰਗਵਾਵਾਂਗੀ ਅਤੇ ਤੁਸੀਂ ਮੈਨੂੰ ਇੱਦਾਂ ਹੀ ਭੇਜੋਗੇ ਹਾਂਜੀ ਹਾਂਜੀ ਠੀਕ ਹੈ ਹਾਂਜੀ ਬਹੁਤ ਹੀ ਵਧੀਆ ਪ੍ਰੋਡਕਟ ਸੀ ਕੁੜਤੀ ਦਾ ਕੁੜਤੀ ਦਾ ਕੱਪੜਾ ਵੀ ਬਹੁਤ ਹੀ ਜ਼ਿਆਦਾ ਵਧੀਆ ਸੀ ਅਤੇ ਟਾਈਮ ਦੇ ਵਿੱਚ ਵੀ ਕੋਈ ਮੈਨੂੰ ਰੁਕਾਵਟ ਨਹੀਂ ਆਈ ਮੈਂ ਪੰਜ ਦਿਨਾਂ ਲਈ ਚਾਹੁੰਦੀ ਸੀ ਕਿ ਮੈਨੂੰ ਮਿਲ ਜਾਵੇ ਅਤੇ ਮੈਨੂੰ ਪੰਜ ਦਿਨਾਂ ਦੇ ਅੰਦਰ ਅੰਦਰ ਹੀ ਮੇਰੇ ਕੋਲ ਉਹ ਕੱਪੜਾ ਆ ਗਿਆ ਸੀ ਹਾਂਜੀ ਹਾਂਜੀ ਕੁੜਤੀ ਦਾ ਬਹੁਤ ਹੀ ਜ਼ਿਆਦਾ ਵਧੀਆ ਸੀ ਮੈਨੂੰ ਬਹੁਤ ਪਸੰਦ ਆਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇੰਨੇ ਵੱਧੇ ਕੱਪੜਿਆਂ ਦੇ ਵਿੱਚ ਮੈਨੂੰ ਕੁੜਤੀ ਭੇਜੀ ਧੰਨਵਾਦ ਜੀ